ਹੈਲੋ ਹਾਂਜੀ ਹਾਂਜੀ ਸੀਰੀਆ ਸਾਈਕਲ ਸਟੋਰ ਤੋਂ ਬੋਲ ਰਹੇ ਹਾਂ ਹਾਂਜੀ ਆਪਣੇ ਕੋਲ ਜੀ ਬੱਚਿਆਂ ਵਾਲੇ ਸਾਇਕਲ ਹੈ ਨੌਜਵਾਨਾਂ ਵਾਲੇ ਜੇ ਬਜ਼ੁਰਗਾਂ ਲਈ ਆਪਣੇ ਕੋਲ ਲੇਡੀਸ ਸਾਈਕਲ ਗਰਲਸ ਲਈ ਵੀ ਹੁੰਦੇ ਆ ਸਾਰੇ ਭਾਂਤ ਦੇ ਸਾਇਕਲ ਹੀ ਆ ਆਪਣੇ ਕੋਲ ਤੁਸੀਂ ਕਿਨ੍ਹਾਂ ਲਈ ਸਾਇਕਲ ਲੈਣਾ ਹੈਗਾ ਠੀਕ ਹੈ ਹਾਂਜੀ ਰੇਂਜਰ ਸਾਈਕਲ ਆਪਣੇ ਕੋਲੋਂ ਬਹੁਤ ਵਧੀਆ ਕੰਪਨੀ ਦੇ ਜਿਹੜੇ ਮਿਲ ਜਾਂਦੇ ਆ ਅਤੇ ਤੁਸੀਂ ਆ ਜਾਓ ਜਦੋਂ ਮਰਜ਼ੀ ਵਿਜ਼ਟ ਕਰਿਓ ਹਾਂਜੀ ਹਾਂਜੀ ਆਪਣੇ ਕੋਲ ਜਿਹੜੇ ਰੈਂਜਰ ਸਾਇਕਲ ਆ ਨਾ ਉਹਨਾਂ ਦੇ ਵਿੱਚ ਵਾਹ ਵਾਹ ਤਰ੍ਹਾਂ ਦੇ ਵਰਾਇਟੀਆਂ ਹੁੰਦੀਆਂ ਜਿਵੇਂ ਮੰਨ ਲਓ ਕੁਝ ਪਤਲੇ ਟਾਇਰਾਂ ਵਾਲੇ ਸਾਈਕਲ ਕੁਛ ਮੋਟੇ ਟਾਇਰਾਂ ਵਾਲੇ ਸਾਈਕਲ ਹੈ ਉਹ ਚਲਾਉਣ 'ਤੇ ਡਿਪੈਂਡ ਕਰਦਾ ਵੀ ਤੁਸੀਂ ਥੋੜ੍ਹੀ ਵਾਟ ਚਲਾਉਣੇ ਆ ਜਾਂ ਲੰਮਾ ਚਲਾਉਣਾ ਜਾਂ ਰੈਗੁਲਰ ਚਲਾਉਣੀ ਆ ਤੁਸੀਂ ਵਰਤਣਾ ਕਿਵੇਂ ਜੀ ਸਾਈਕਲ ਮੈਨੂੰ ਇਹ ਦੱਸੋ ਥੋੜ੍ਹਾ ਜਿਹਾ ਹਾਂ ਠੀਕ ਹੈ ਮੰਨ ਲਓ ਜੀ ਤੁਸੀਂ ਰੈਗੂਲਰ ਵਰਤਣਾ ਸ਼ੌਂਕ ਨੂੰ ਵਰਤਣਾ ਹਾਂ ਆਪਣੇ ਕੋਲ ਇੱਕ ਬਿਲਕੁਲ ਪਤਲੇ ਟਾਇਰਾਂ ਨੂੰ ਹੁੰਦਾ ਇੱਕ ਮੋਟੇ ਟਾਇਰਾਂ ਉਹਨਾਂ ਦੇ ਵਿਚਾਲੇ ਇੱਕ ਮੀਡੀਅਮ ਟਾਇਰ ਵਾਲਾ ਹੁੰਦਾ ਤੁਸੀਂ ਉਹ ਸਾਈਕਲ ਲਓ ਉਹ ਤੁਹਾਡੇ ਲਈ ਸਭ ਤੋਂ ਵਧੀਆ ਹੋਊਗਾ ਉਹਦੇ ਵਿੱਚ ਅੱਡੋ ਅੱਡ ਕੰਪਨੀਆਂ ਦੇ ਅੱਡੋ ਅੱਡ ਰੇਟ ਆ ਜਿਵੇਂ ਮੰਨ ਕੇ ਚਲੋ ਇੱਕ ਹੀਰੋ ਸਾਈਕਲ ਹੀਰੋ ਕੰਪਨੀ ਦਾ ਆਉਂਦਾ ਉਹ ਪੱਚੀ ਹਜ਼ਾਰ ਦੀ ਰੇਂਜ ਦਾ ਇੱਕ ਉਸ ਤੋਂ ਆਪਣੇ ਆਉਂਦਾ ਬੈਨ ਕੰਪਨੀ ਦਾ ਉਹ ਉਹ ਹੈਗਾ ਅਠਾਰਾਂ ਹਜ਼ਾਰ ਦਾ ਇੱਕ ਸਪਾਰਕ ਕੰਪਨੀ ਦਾ ਆਉਂਦਾ ਉਹ ਆਪਣੇ ਕੋਲ ਵੀਹ ਕੁ ਹਜ਼ਾਰ ਦਾ ਪੈਂਦਾ ਹੈ ਤੁਾਹਡਾ ਬਜਟ ਕਿੰਨਾ ਕੁ ਹੈ ਦਸ ਬਾਰਾਂ ਦੇ ਵਿੱਚ ਹਾਂ ਇੱਕ ਨਾ ਅਸੀਂ ਆਪ ਵੀ ਮੈਨੂਫੈਕਚਰ ਕਰਦੇ ਹਾਂ ਸਾਈਕਲ ਸੀਵੀਆ ਸਾਈਕਲ ਸੀਵੀਆ ਸਾਈਕਲ ਦੇ ਨਾਂ 'ਤੇ ਮਤਲਬ ਸਾਡਾ ਆਪਣਾ ਹੈਗਾ ਮੈਨੂਫੈਕਚਰਿੰਗ ਉਹ ਤੁਹਾਨੂੰ ਮੰਨ ਕੇ ਚਲੋ ਤੇਰਾਂ ਕੁ ਹਜ਼ਾਰ ਰੁਪਏ ਤੱਕ ਦਾ ਪੈ ਜਾਊਗਾ ਸਾਈਕਲ ਦੀ ਪੂਰੀ ਗਰੰਟੀ ਹੋਊਗੀ ਪੰਜ ਸਾਲ ਦੀ ਉਹਦੀ ਗਰੰਟੀ ਦਿੰਦੇ ਹਾਂ ਮੰਨ ਕੇ ਚਲੋ ਟਾਇਰ 'ਚ ਕੋਈ ਖਰਾਬੀ ਆਉਂਦੀ ਆ ਟੁੱਟ ਜਾਵੇ ਜਾਂ ਫਟ ਜਾਂਦਾ ਟਾਇਰ ਤਾਂ ਉਹ ਅਸੀਂ ਨਵਾਂ ਦਿੰਦੇ ਹਾਂ ਰਿਪੇਅਰ ਨਹੀਂ ਕਰਦੇ ਟਾਇਰ ਦੀ ਜਾਂ ਕੋਈ ਹੋਰ ਫਲਟ ਹੁੰਦਾ ਗੇਅਰਾਂ 'ਚ ਮੰਨ ਕੇ ਚੱਲੋ ਕੋਈ ਖਰਾਬੀ ਪੈਂਦੀ ਐ ਤਾਂ ਆਪਾਂ ਗੇਅਰ ਪੂਰੇ ਦਾ ਪੂਰਾ ਸੈਟ ਨਵਾਂ ਬਦਲ ਕੇ ਦਿੰਦੇ ਹਾਂ ਉਹਦੀ ਰਿਪੇਅਰ ਨਹੀਂ ਕਰਦੇ ਪੰਜ ਸਾਲ ਤੱਕ ਦੀ ਆਪਣੀ ਗਰੰਟੀ ਹੋ ਗਈ ਫੁੱਲ ਉਹਦੀ

ਹਾਂ ਉਹ ਆਪਾਂ ਦੇਖ ਲਾਂਗੇ ਇਹ ਤੁਸੀਂ ਜਦੋਂ ਸਾਈਕਲ ਲੈ ਕੇ ਆਓਗੇ ਆਪਣੇ ਕੋਲ ਆਪਾਂ ਦੇਖ ਲਾਂਗੇ ਉਹ ਕੱਟਿਆ ਜਾਊਗਾ ਵਿੱਚ ਉਹਨੂੰ ਹਜ਼ਾਰ ਦੋ ਹਜ਼ਾਰ ਰੁਪਇਆ ਜਿੰਨੇ ਵੀ ਹਾਲਤ ਦੇਖ ਕੇ ਆਪਾਂ ਕੱਟ ਲਾਂਗੇ ਠੀਕ ਹੈ ਜੀ ਜੀ ਆਇਆ ਨੂੰ